ਬਾਈਕ ਚਲਾਉਣਾ ਇੱਕ ਅੱਜ ਕੱਲ੍ਹ ਦਾ ਜਨੂੰਨ ਜਿਹਾ ਹੀ ਬਣ ਗਿਆ ਪਰ ਆ ਕੁਛ ਸਮੇਂ ਪਹਿਲਾਂ ਬਾਈਕ ਚਲਾਉਣ ਦਾ ਅਲੱਗ ਏ ਅੰਦਾਜ਼ ਸੀ ਅਲੱਗ ਏ ਮਜ਼ਾ ਸੀਗਾ ਅੱਜ ਕੱਲ੍ਹ ਤਾਂ ਮੰਡੀਰ ਬਾਈਕ ਜਣਾ ਖਣਾ ਹੀ ਚੱਕੀ ਫਿਰਦੀ ਆ ਕੋਈ ਕੋਈ ਟਰਨ ਰਾਈਟ ਜਾਂ ਲੈਫਟ ਟਰਨ ਲੈਣੀ ਆ ਤਾਂ ਉਹਨਾਂ ਦਾ ਕੋਈ ਇੰਡੀਕੇਸ਼ਨ ਨਹੀਂ ਕਰਨੀ ਕੋਈ ਇੰਡੀਕੇਟਰ ਨਹੀਂ ਦੇਣਾ ਕੋਈ ਹੱਥ ਦਾ ਇਸ਼ਾਰਾ ਨਹੀਂ ਕਰਨਾ ਜਦੋਂ ਮੋੜ ਆ ਗਿਆ ਮੋੜਤਾ ਫਟਾਫਟ ਪਿਛਲਾ ਆ ਕੇ ਭਾਵੇਂ ਵਿੱਚ ਵੱਜੇ ਮਰੇ ਭਾਵੇਂ ਬਚੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਪਰ ਪਿੱਛੇ ਨੂੰ ਮੂੰਹ ਘੁੰਮਾ ਕੇ ਨਹੀਂ ਦੇਖਣਾ ਪਰ ਬਾਈਕ ਚਲਾਉਣ ਵੇਲੇ ਤਾਂ ਬਹੁਤ ਭਾਵਨਾਵਾਂ ਮਹਿਸੂਸ ਕਰਨੀਆਂ ਚਾਹੀਦੀਆਂ ਕਿ ਮੇਰੀ ਜਿਹੜੀ ਜ਼ਿੰਦਗੀ ਆ ਉਹ ਮੇਰੇ ਘਰਦਿਆਂ ਨੇ ਉਸ ਦੀ ਬਹੁਤ ਲੋੜ ਆ ਅਤੇ ਮੇਰੇ ਨਾਲ ਜਿਹੜੇ ਟਕਰਾ ਕੇ ਜਿਹਦੀ ਨੁਕਸਾਨ ਹੋਊਗਾ ਉਹਦੇ ਵੀ ਘਰਦਿਆਂ ਨੂੰ ਬਹੁਤ ਲੋੜ ਆ ਜਿਸ ਕਰਕੇ ਬਾਈਕ ਚਲਾਉਣ ਵੇਲੇ ਬਹੁਤ ਖ਼ਿਆਲ ਰੱਖਣਾ ਪੈਂਦਾ ਪਹਿਲਾਂ ਜਦੋਂ ਅਸੀਂ ਬੱਚੇ ਹੁੰਦੇ ਤੀ ਬਾਈਕ ਦਾ ਤਜ਼ਰਬਾ ਕਿੱਥੋਂ ਹੋਇਆ ਜਦੋਂ ਬੱਚੇ ਛੋਟੇ ਹੁੰਦੇ ਸੀ ਅਸੀਂ ਮੈਨੂੰ ਕਿਸੇ ਦੇ ਮਗਰ ਬੈਠ ਕੇ ਚਲੇ ਜਾਈਦਾ ਸੀਗਾ ਤਾਂ ਬੜਾ ਮਜ਼ਾ ਆਇਆ ਕਰੇ ਤਾਂ ਮਨ 'ਚ ਇਹ ਹੋਇਆ ਵੀ ਯਾਰ ਆਪਣਾ ਬਾਈਕ ਹੋਣਾ ਚਾਹੀਦਾ ਫਿਰ ਕਿਵੇਂ ਨਾ ਕਿਵੇਂ ਕਰਕੇ ਮੰਮੀ ਪਾਪਾ ਨੂੰ ਮਨਾ ਕਰਕੇ ਇੱਕ ਆਪਣਾ ਬਾਈਕ ਦਾ ਇੰਤਜ਼ਾਮ ਕੀਤਾ ਉਸ ਨੂੰ ਬਹੁਤ ਹੀ ਢੰਗ ਨਾਲ ਜਨੂੰਨ ਵਜੋਂ ਨਹੀਂ ਚਲਾਇਆ ਕਾਨੂੰਨ ਵਜੋਂ ਚਲਾਇਆ ਬਹੁਤ ਢੰਗ ਨਾਲ ਚਲਾਇਆ ਆਲਾ ਦੁਆਲਾ ਦੇਖ ਕੇ ਅਤੇ ਕਿੱਥੇ ਕਿਹੜੀ ਜਗ੍ਹਾ 'ਤੇ ਕਿੰਨੀ ਇਹਦੀ ਸਪੀਡ ਕਰਨੀ ਚਾਹੀਦੀ ਆ ਕਿਵੇਂ ਬ੍ਰੇਕ ਲਾਉਣੇ ਆ ਇੱਕਦਮ ਬ੍ਰੇਕ ਨਹੀਂ ਲਾਉਣੇ ਕਈ ਜਗ੍ਹਾ 'ਤੇ ਅਗਲੇ ਪਿਛਲੇ ਬ੍ਰੇਕ ਇਕੱਠੇ ਵੀ ਮਾਰਨੇ ਪੈ ਜਾਂਦੇ ਸੀਗੇ ਮਾਰੀ ਦੇ ਸੀ ਲੇਕਿਨ ਤਿਲਕਣਬਾਜ਼ੀ ਤੋਂ ਬੱਚ ਕੇ ਮੋਟਰਸਾਈਕਲ ਮੈਨੇ ਬਾਈਕ ਆਪਣਾ ਚਲਾਇਆ ਅਤੇ ਬੜੇ ਮਜ਼ਾ ਆਇਆ ਜਿੱਦਾਂ ਅੱਜ ਵੀ ਚਲਾ ਰਿਹਾ